ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਛਾ ਜੀ ਅੱਛਾ ਜੀ ਜ਼ਰੂਰ ਆਇਓ ਨਹੀਂ ਜੀ ਬਿਲਕੁਲ ਫ਼ਰੀ ਹੈ ਘੁੰਮਣ ਫਿਰਨੇ ਦਾ ਪਾਰਕ ਗਾਰਡਨ ਦਾ ਰਣਜੀਤ ਸਿੰਘ ਪਾਰਕ ਸ਼ਹੀਦ ਭਗਤ ਸਿੰਘ ਪਾਰਕ ਹੈ ਜਵਾਹਰਲਾਲ ਨਹਿਰੂ ਦਾ ਪਾਰਕ ਹੈ ਹਾਂਜੀ ਬਹੁਤ ਵਧੀਆ ਹੈ ਘੁੰਮਣ 'ਚ ਨੌਲੇਜ ਵਗੈਰਾ ਪ੍ਰੋਵਾਇਡ ਬਹੁਤ ਹੁੰਦੇ ਹੈ ਅੱਛਾ ਜੀ ਅੱਛਾ ਜੀ ਤੁਸੀਂ ਮੈਨੂੰ ਆ ਕੇ ਕੋਲ ਕਰ ਦਿਓ ਮੈਂ ਤੁਹਾਨੂੰ ਐਡਰੈਸ ਵਗੈਰਾ ਦੱਸ ਦਵਾਂਗੀ ਜਾਂ ਮੈਂ ਆਪੇ ਆ ਜਾਵਾਂਗੀ ਠੀਕ ਹੈ ਤੁਸੀਂ ਕਿਹੜੇ ਹੋਟਲ 'ਚ ਰੁਕੋਂਗੇ

ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਇੱਕ ਵਾਰੀ ਮੈਨੂੰ ਆਉਣ ਤੋਂ ਪਹਿਲਾਂ ਇੱਕ ਵਾਰੀ ਫ਼ੋਨ ਜ਼ਰੂਰ ਕਰ ਦਿਓ ਜੀ ਠੀਕ ਹੈ ਜੀ ਅਤੇ ਅੱਛਾ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ